ਹੈਲੋ ਸਤ ਸਤਿ ਸ੍ਰੀ ਅਕਾਲ ਦੀਦੀ ਵਧੀਆ ਵਧੀਆ ਠੀਕ ਹੈ ਦੀਦੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਬੱਚੇ ਵਧੀਆ ਠੀਕ ਨੇ ਚਲੋ ਠੀਕ ਹੈ ਹਾਂਜੀ ਦੱਸੋ ਦੀਦੀ ਹਾਂਜੀ ਓ ਇਹ ਬੱਚੇ ਵੀ ਠੀਕ ਹੈ ਦੀਦੀ ਉਹ ਨਾ ਸਕੂਲੇ ਇੱਕ ਦਿਨ ਟੀਚਰ ਨੇ ਕਿਤੇ ਬੇਟੀ ਨੂੰ ਮਾਰਿਆ ਸੀ ਨਾ ਅਤੇ ਉਹਦਾ ਕੰਨ ਬਹੁਤ ਲਾਲ ਸੀਗਾ ਪਰ ਉਹਨੇ ਘਰੇ ਆਣ ਕੇ ਦੱਸਿਆ ਨਹੀਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਮਮਾ ਕੁਛ ਨਹੀਂ ਹੋਇਆ ਗਾ ਫਿਰ ਮੈਂ ਉਹਨਾਂ ਨੂੰ ਵਰਚਾ ਜੂ ਕੇ ਪੁੱਛਿਆ ਕਹਿੰਦੇ ਮਮਾ ਮੈਨੂੰ ਮੈਡਮ ਨੇ ਚਪੇੜ ਮਾਰੀ ਹੈ ਅਤੇ ਬੱਚੇ ਦੀ ਗਲਤੀ ਵੀ ਕੋਈ ਨਹੀਂ ਹੈ ਬੱਚੇ ਨੇ ਹੋਮ ਵਰਕ ਸਾਰਾ ਕੀਤਾ ਸੀ ਅਤੇ ਪਰ ਫਿਰ ਵੀ ਪਤਾ ਨਹੀਂ ਕਿਉਂ ਟੀਚਰ ਨੇ ਬੱਚੇ ਨੂੰ ਕਿੰਨਾ ਡਾਂਟਿਆ

ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਇਹ ਸੋਚਿਆ ਵੀ ਬੱਚੇ ਦਾ ਸਕੂਲ ਚੇਂਜ ਕਰਵਾਉਣ ਵਾਸਤੇ ਇੱਕ ਦੋ ਸਕੂਲਾਂ ਬਾਰੇ ਪੁੱਛਿਆ ਵੀ ਬੱਚਿਆਂ ਨੂੰ ਸਕੂਲ ਕਿਸ ਤਰ੍ਹਾਂ ਦਾ ਇਹ

ਹਾਂਜੀ ਹਾਂਜੀ ਆ ਇੱਕ ਦੋ ਸਕੂਲ ਹੈਗੇ ਨੇ ਜਿਵੇਂ ਆਪਣੇ ਗੁਰੂ ਨਾਨਕ ਹੋ ਗਿਆ ਡੀ ਐਨ ਐਸ ਹੋ ਗਿਆ ਅਤੇ ਫਿਰ ਮਾਡਲ ਹੋ ਗਿਆ

ਹਾਂਜੀ ਹਾਂਜੀ ਹਾਂਜੀ ਮੇਰੀ ਵੀ ਇਹੀ ਇਰਾਦਾ ਜਾਂ ਡੀਐਨਐਸ ਬੱਚੇ ਬਿਠਾਣ ਦਾ ਅਤੇ ਜਾਂ ਗੁਰੂ ਨਾਨਕ ਇਹਨਾਂ ਦੋਨਾਂ ਸਕੂਲਾਂ 'ਚ ਨਾ ਟੇਸਟ ਬਹੁਤ ਵਧੀਆ ਨੇ ਆਪਣੇ ਯਾਨੀ ਕਿ ਆਪਣੇ ਜਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਨੇ ਉਸੇ ਤਰ੍ਹਾਂ ਹੀ ਇੱਕ ਟਰਾਈ ਕਰਵਾਂਦੇ ਨੇ ਐਕਟੀਵਿਟੀ ਵੀ ਬਹੁਤ ਬੱਚਿਆਂ ਨੂੰ ਕਰਵਾ ਰਹੇ ਨੇ ਸਕੂਲ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਕੁਛ ਇਹ ਨਾ ਦੇ ਇਹ ਨਾ ਬੱਚਿਆਂ ਨੂੰ ਐਕਸਟਰਾ ਖਰਚੇ ਬਹੁਤ ਪਾ ਰਹੇ ਨੇ ਜਿਵੇਂ ਕਿ ਪੱਖੇ ਖਰਾਬ ਹੋਗੇ ਜਨਰੇਟਰ ਖਰਾਬ ਹੋ ਗਏ ਜਨਰੇਟਰ 'ਚ ਤੇਲ ਖਤਮ ਹੋ ਗਿਆ ਐਵੇਂ ਦੇ ਐਕਸਟਰਾ ਬੱਚਿਆਂ ਨੂੰ ਖਰਚੇ ਬਹੁਤ ਜ਼ਿਆਦਾ ਪਾ ਰਹੇ ਨੇ ਹਾਂਜੀ ਹਾਂਜੀ ਹਾਂਜੀ ਕਿਉਂਕਿ ਬੱਚੇ ਬਹੁਤ ਛੋਟੇ ਨੇ ਜਿਹਦੀ ਵੀ ਇਹਨਾਂ ਨੂੰ ਚਾਹੀਦਾ ਵੀ ਕਿਉਂਕਿ ਬੱਚੇ ਸਕੂਲੇ ਬਹੁਤ ਵਧੀਆ ਪੜ੍ਹ ਰਹੇ ਨੇ ਹਾਂਜੀ ਅਤੇ ਫਿਰ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੁਣ ਵੇਖੋ ਜੀ ਸਾਰਾ ਪਹਿਲਾਂ ਦੇਖਾਂਗੇ ਬੱਚੇ ਦੀ ਸਕੂਲ ਦੀ ਪੜ੍ਹਾਈ ਕਿੱਥੇ ਵਧੀਆ ਹੈਗੀ ਹੈ ਅਤੇ ਕਿੱਥੇ ਨਹੀਂ ਫਿਰ ਉਸ ਹਿਸਾਬ 'ਚ ਬੱਚਿਆਂ ਨੂੰ ਨਾ ਸਲਾਹ ਕਰਕੇ ਫਿਰ ਇੱਥੇ ਬੱਚੇ ਇਕੱਠੇ ਬਿਠਾਵਾਂਗੇ ਇਹਨਾਂ ਦੇ ਪਤਾ ਲੱਗ ਜਾਏਗਾ ਵੀ ਬੱਚਿਆਂ ਦੇ ਕਿਵੇਂ ਪੜ੍ਹਾਈ ਹੁੰਦੀ ਹਾਂਜੀ ਹਾਂਜੀ ਚਲੋ ਠੀਕ ਹੈ ਤੁਸੀਂ ਇੱਕ ਵਾਰੀ ਇਹਨਾਂ ਕੋਲੋਂ ਪਤਾ ਕਰ ਲੈਣਾ ਅਤੇ ਮੈਂ ਵੀ ਪਤਾ ਕਰਨੀ ਆ ਫਿਰ ਆਪਾਂ ਦੇਖਦੇ ਆ ਕਿੱਥੇ ਬੱਚਿਆਂ ਨੂੰ ਹਾਂਜੀ ਬਿਠਾਣੇ ਆ ਅਤੇ ਹਾਂਜੀ ਤੁਸੀਂ ਵੀ ਇੱਕ ਵਾਰੀ ਘਰੇ ਸਾਰਿਆਂ ਨਾਲ ਸਲਾਹ ਕਰ ਲੈਣਾ ਅਤੇ ਅਸੀਂ ਵੀ ਘਰੇ ਇੱਕ ਵਾਰੀ ਸਾਰੇ ਬੈਠੇ ਕੇ ਸਲਾਹ ਕਰਾਂਗੇ ਕਿੱਥੇ ਹਾਂਜੀ ਹਾਂਜੀ ਚਲੋ ਫਿਰ ਵੀ ਤੁਸੀਂ ਇੱਕ ਵਾਰੀ ਘਰਦਿਆਂ ਨਾਲ ਸਲਾਹ ਕਰੋ ਮੈਂ ਵੀ ਇੱਕ ਵਾਰੀ ਸਾਡੇ ਘਰਦਿਆਂ ਨਾਲ ਸਲਾਹ ਕਰਨੀ ਆ ਵੀ ਕੀ ਕਹਿ ਰਹੇ ਨੇ ਹਾਂਜੀ ਫਿਰ ਉੱਥੇ ਆਪਾਂ ਬੱਚਿਆਂ ਨੂੰ ਬਿਠਾ ਦਿੰਦੇ ਨਾਲੇ ਆਪਣੀ ਜਾਣ ਪਛਾਣ ਹੈਗੀ ਇੱਥੇ ਹਾਂਜੀ ਹਾਂਜੀ ਇੱਕ ਦੇ ਦਿਓ ਓਕੇ